ਮੈਂ ਗਣੇਸ਼ ਉਤਸਵ ਦੇ ਸਮੇਂ ਗਣੇਸ਼ ਦੀ ਮੂਰਤੀ ਬਣਾਈ ਸੀ ਜਿਸਨੂੰ ਬਣਾਉਣ ਤੋਂ ਪਹਿਲਾਂ ਮੈਂ ਇੱਕ ਸੁੱਚਮ ਮਿੱਟੀ ਲਈ ਸੀ ਸੁੱਚਮ ਮਿੱਟੀ ਨੂੰ ਮੈਂ ਇੱਕ ਪੂਰਾ ਦਿਨ ਗਿੱਲਾ ਕਰਕੇ ਰੱਖਿਆ ਸੀ ਅਤੇ ਉਸਨੂੰ ਗਿੱਲੇ ਹੋਣ ਤੋਂ ਬਾਅਦ ਮੈਂ ਉਸਨੂੰ ਗਣੇਸ਼ ਦੀ ਸੇਪ ਵਿੱਚ ਗਣੇਸ਼ ਜੀ ਦਾ ਆਕਾਰ ਦਿੱਤਾ ਸੀ ਆਕਾਰ ਦੇਣ ਤੋਂ ਬਾਅਦ ਮੈਂ ਉਸ ਨੂੰ ਕਈ ਦਿਨਾਂ ਤੱਕ ਮਿੱਟੀ ਸੁੱਕਣ ਲਈ ਧੁੱਪ ਵਿੱਚ ਰੱਖੀ ਸੀ ਅਤੇ ਸੁੱਕਣ ਤੋਂ ਬਾਅਦ ਮੈਂ ਉਸ ਨੂੰ ਉਸ ਉਸ ਉੱਤੇ ਪੇਂਟ ਕੀਤਾ ਪੇਟ ਕਰਨ ਤੋਂ ਬਾਅਦ ਅਸੀਂ ਗਣੇਸ਼ ਗਣੇਸ਼ ਜੀ ਦੀ ਆਪਣੇ ਘਰ ਵਿੱਚ ਰੱਖ ਕੇ ਸਥਾਪਨਾ ਕੀਤੀ ਅਤੇ ਸਥਾਪਨਾ ਕਰਨ ਤੋਂ ਬਾਅਦ ਅਸੀਂ ਗਣੇਸ਼ ਜੀਆਂ ਦੀ ਕਈ ਦਿਨਾਂ ਤੱਕ ਪੂਜਾ ਕੀਤੀ ਪੂਜਾ ਕਰਨ ਤੋਂ ਬਾਅਦ ਮੈਂ ਬੜੇ ਹੀ ਪਿਆਰ ਨਾਲ ਬਣਾਈ ਗਣੇਸ਼ ਦੀ ਮੂਰਤੀ ਨੂੰ ਵਿਸਰਜਨ ਕਰਕੇ ਆਈ